ਹੈਲੋ ਸਰ ਤੁਸੀਂ ਸਾਗਰ ਰਤਨਾ ਤੋਂ ਗੱਲ ਕਰ ਰਹੇ ਹੋ ਸਰ ਮੈਂ ਤੁਹਾਡੇ ਰੈਸਟੋਰੈਂਟ ਤੋਂ ਦਸ ਲੋਕਾਂ ਦੇ ਲਈ ਖਾਣਾ ਔਡਰ ਕੀਤਾ ਹੈ ਸਰ ਗੱਲ ਇੱਦਾਂ ਹੈ ਕਿ ਮੈਂ ਅਤੇ ਮੇਰੀ ਫੈਮਿਲੀ ਟਰਿਪ 'ਤੇ ਜਾ ਰਹੇ ਹਾਂ ਠੀਕ ਹੈ ਬਟ ਮੈਂ ਆਪਣੇ ਨਾਲ ਕਟਲਰੀ ਡਿਸਪੋਜਲ ਪਲੇਟਾਂ ਕਾਂਟਾ ਚਮਚ ਇਹ ਜਿਹਾ ਕੁਛ ਰੱਖਣਾ ਭੁੱਲ ਗਈ ਹਾਂ ਤਾਂ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਇਹ ਹੀ ਹੈ ਕਿ ਤੁਸੀਂ ਪਲੀਸ ਆਪਣੇ ਖਾਣੇ ਦੇ ਨਾਲ ਮੈਨੂੰ ਕਟਲਰੀ ਦੇ ਦਿਓ ਸਰ ਤੁਹਾਡੇ ਹੋਟਲ ਦਾ ਖਾਣਾ ਬਹੁਤ ਹੀ ਜ਼ਿਆਦਾ ਅੱਛਾ ਹੁੰਦਾ ਹੈ ਮੈਂ ਤਾਂ ਹੀ ਤੁਹਾਡੇ ਖੋਟਲ ਤੋਂ ਖਾਣਾ ਓ ਡਰ ਕੀਤਾ ਹੈ ਆਪਣੀ ਫੈਮਿਲੀ ਦੇ ਵਾਸਤੇ ਤਾਂ ਕਿ ਸਾਡਾ ਟ੍ਰਿਪ ਹੈ ਜਿਹੜਾ ਬਹੁਤ ਵਧੀਆ ਇੰਜੋਏ ਅਸੀਂ ਕਰ ਸਕੀਏ ਸਰ ਮੈਂ ਤੁਹਾਨੂੰ ਫਿਰ ਬੇਨਤੀ ਕਰਦੀ ਹਾਂ ਕਿ ਤੁਸੀਂ ਕਟਲਰੀ ਸ ਪ ਪਲੇਟ ਕਾਂਟਾ ਚਮਚ ਇਹ ਜਿਹਾ ਕੁਛ ਸਾਰਾ ਸਮਾਨ ਦੇ ਦਿਓ ਸਰ ਅਗਰ ਤੁਸੀਂ ਨਹੀਂ ਸਾਨੂੰ ਪਰਵਾ ਦਿਓਗੇ ਸਾਨੂੰ ਤਾਂ ਸਾਡਾ ਖਾਣਾ ਖਾਣ ਦਾ ਮਜ਼ਾ ਨਹੀਂ ਆਉਣਾ ਗਾ ਸਰ ਮੈਂ ਆਪਣੇ ਅੱਗੇ ਦੋਸਤ ਮਿੱਤਰਾਂ ਨੂੰ ਵੀ ਇਹ ਹੀ ਕਹੂੰਗੀ ਕਿ ਤੁਹਾਡੇ ਖਾਣੇ ਦੀ ਉਹ ਤੁਹਾਡਾ ਖਾਣਾ ਓਡਰ ਕਰਨ ਉਹ ਤੁਹਾਡੇ ਹੋਟਲ ਦੇ ਵਿੱਚ ਸਰ ਤੁਹਾਡਾ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਖਾਣਾ ਹੁੰਦਾ ਹੈ ਤੁਸੀਂ ਇੱਕ ਬਹੁਤ ਵਧੀਆ ਹਾਈਜੈਨਿਕ ਯੂਜ ਕਰਦੇ ਹੋ ਤੁਹਾਡੀ ਕਿਚਨ ਬਹੁਤ ਸਾਫ਼ ਸੁਥਰੀ ਹੈ ਮੈਂ ਖੁਦ ਆਪਣੇ ਅੱਖੀਂ ਦੇਖੀ ਹੋਈ ਹੈ ਤੁਹਾਡੀ ਕਿਚਨ ਮੇਰੀ ਬੇਨਤੀ ਇਹ ਹੀ ਹੈ ਕਿ ਤੁਸੀਂ ਪਲੀਸ ਖਾਣਾ ਵੀ ਵਧੀਆ ਦਿਓ ਅਤੇ ਸਾਨੂੰ ਨਾਲ ਕਟਲਰੀ ਵੀ ਪ੍ਰੋਵਾਈਡ ਕਰ ਦਿਓ ਬਾਕੀ ਤੁਹਾਡਾ ਹੋਟਲ ਵਿੱਚ ਬੈਠਣ ਦਾ ਸਿਸਟਮ ਖਾਣਾ ਭੇਜਣ ਦਾ ਸਿਸਟਮ ਉਸਦੀ ਪ੍ਰੈਪਰੇਸ਼ਨ ਸਭ ਕੁਛ ਹੀ ਬਹੁਤ ਵਧੀਆ ਹੈ ਜੋ ਕਿ ਮੈਂ ਤਰੀਫ਼ ਨਹੀਂ ਕਰ ਸਕਦੀ ਕਿ ਤੁਹਾਡਾ ਖਾਣਾ ਕਿੰਨਾ ਕੁ ਵਧੀਆ ਹੈ ਮੈਂ ਹਰ ਇੱਕ ਜਾਣੇ ਨੂੰ ਇਹ ਹੀ ਕਹੂੰਗੀ ਕਿ ਤੁਹਾਡੇ ਹੋਟਲ ਤੋਂ ਹੀ ਓਡਰ ਕਰਨ ਠੀਕ ਹੈ ਸਰ ਪਲੀਸ ਸਾਡੇ ਟ੍ਰਿਪ ਨੂੰ ਵਧੀਆ ਤੋਂ ਵਧੀਆ ਰੱਖਣ ਦੇ ਲਈ ਤੁਸੀਂ ਪਲੀਸ ਮੈਨੂੰ ਕਟਲਰੀ ਇਹ ਜਿਹਾ ਕੁਛ ਪ੍ਰਦਾਨ ਕਰ ਦਿਓ ਮੈਂ ਬਾਰ ਬਾਰ ਤੁਹਾਨੂੰ ਇਹ ਹੀ ਬੇਨਤੀ ਕਰਦੀ ਹਾਂ ਬਾਕੀ ਸਰ ਤੁਹਾਡਾ ਸਾਗਰ ਰਤਨਾ ਇੱਕ ਇਹ ਜਿਹਾ ਬ੍ਰਾਂਡ ਹੈ ਜੋ ਕਿ ਹਰ ਇੱਕ ਸਿਟੀ ਦੇ ਵਿੱਚ ਹੈ ਅਤੇ ਹਰ ਕੋਈ ਇੱਥੇ ਸਾਊਥ ਇੰਡੀਅਨ ਖਾਣਾ ਬਹੁਤ ਜ਼ਿਆਦਾ ਪਸ ਪਸੰਦ ਕਰਦਾ ਹੈ ਤੁਹਾਡਾ ਇੱਕ ਡੋਸਾ ਜਿਸਦੀ ਕਿ ਮੈਂ ਬਹੁਤ ਵੱਡੀ ਫੈਨ ਹਾਂ ਮਸਾਲਾ ਡੋਸਾ ਬਟਰ ਡੋਸਾ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਜੋ ਤੁਸੀਂ ਉਸਦੇ ਨਾਲ ਦੋ ਚਟਨੀਆਂ ਦਿੰਦੇ ਹੋ ਕੋਕੋਨਟ ਚਟਨੀ ਐਂਡ ਰੈਡ ਵਾਲੀ ਚਟਨੀ ਉਹ ਤਾਂ ਬਹੁਤ ਹੀ ਜ਼ਿਆਦਾ ਔਸਮ ਹੈ ਠੀਕ ਹੈ ਸਰ ਬਾਕੀ ਮੈਂ ਇੱਕ ਵਾਰ ਤੁਹਾਡੇ ਤੋਂ ਦਹੀਂ ਵੜਾ ਟਰਾਈ ਕੀਤਾ ਸੀਗਾ ਤੁਹਾਡੀ ਦਹੀਂ ਇੰਨੀ ਜ਼ਿਆਦਾ ਤਾਜ਼ੀ ਸੀਗੀ ਅਤੇ ਇੰਨੀ ਜ਼ਿਆਦਾ ਮਿੱਠੀ ਸੀਗੀ ਵੀ ਮੈਂ ਦੱਸ ਨਹੀਂ ਸਕਦੀ ਸੋ ਤੁਹਾਡਾ ਦਹੀਂ ਵੜਾ ਵੀ ਬਹੁਤ ਜ਼ਿਆਦਾ ਲਾਜਵਾਬ ਸੀਗਾ ਬਾਕੀ ਅਸੀਂ ਇੱਥੇ ਤੁਹਾਡਾ ਹਰ ਇੱਕ ਫੂਡ ਟਰਾਈ ਕੀਤਾ ਹੋਇਆ ਹੈ ਤਾਂ ਹੀ ਮੈਂ ਤੁਹਾਡੇ ਤੋਂ ਬਾਰ ਬਾਰ ਓਡਰ ਕਰਦੀ ਹਾਂ ਮੇਰੇ ਬੱਚੇ ਵੀ ਤੁਹਾਡੇ ਖਾਣੇ ਦੇ ਬਹੁਤ ਜ਼ਿਆਦਾ ਫੈਨ ਹੈ ਤਾਂ ਹਰ ਵਾਰ ਇਹ ਕਹਿਣਗੇ ਮੰਮਾ ਖਾਣਾ ਓਡਰ ਕਰਨਾ ਤਾਂ ਸਾਗਰ ਰਤਨਾ ਤੋਂ ਕਰਨਾ ਹੈ ਹੋਰ ਕਿਸੇ ਦਾ ਆਪਾਂ ਖਾਣਾ ਨਹੀਂ ਖਾਣਾ ਗਾ ਉਹ ਤਾਂ ਹਰ ਇੱਕ ਚੀਜ਼ ਤੁਹਾਡੇ ਬਹੁਤ ਵੱਡੇ ਫੈਨ ਹੈ ਤਾਂ ਕਰਕੇ ਸਰ ਪਲੀਸ ਮੈਂ ਚਾਹੁੰਦੀ ਹਾਂ ਕਿ ਸਾਡੀ ਟਰਿਪ ਬਹੁਤ ਜ਼ਿਆਦਾ ਯਾਦਗਾਰ ਬਣੇ ਮੇਰੇ ਬੱਚੇ ਵੀ ਯਾਦਗਾਰ ਰੱਖਣ ਇਸ ਟ੍ਰਿਪ ਨੂੰ ਤਾਂ ਕਰਕੇ ਪਲੀਸ ਤੁਸੀਂ ਡਿਸਪੋਜਲ ਪਲੇਟ ਕਾਂਟਾ ਚਮਚ ਇਹ ਜਿਹਾ ਕੁਛ ਦਸ ਪੰਦਰ੍ਹਾਂ ਲੋਕਾਂ ਦੇ ਅਕੋਰਡਿੰਗ ਪਾ ਦਿਓ ਠੀਕ ਹੈ ਤਾਂ ਕਿ ਸਾਨੂੰ ਖਾਣਾ ਖਾਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਬਾਕੀ ਸਰ ਤੁਹਾਡਾ ਔਰ ਤੁਸੀਂ ਇਹ ਸਭ ਕਰ ਦਿੰਦੇ ਹੋ ਮੈਂ ਤੁਹਾਡੀ ਬਹੁਤ ਬਹੁਤ ਆਭਾਰੀ ਰਹਾਂਗੀ ਥੈਂਕ ਯੂ ਸਰ